ਚਿੱਤਰਕਾਰੀ ਕਰਨਾ ਮੇਰਾ ਸ਼ੌਂਕ ਸੀਗਾ ਮੈਂ ਚਿੱਤਰਕਾਰੀ ਜਿਹੜੀ ਹੈਗੀ ਹੈ ਘਰ ਦੇ ਵਿੱਚ ਜੋ ਫਰੀ ਟੈਮ ਹੁੰਦਾ ਸੀਗਾ ਮੈਂ ਕਰਦੀ ਰਹਿੰਦੀ ਸੀ ਫਿਰ ਸਾਡੇ ਸਕੂਲ ਦੇ ਵਿੱਚ ਜਿਹੜਾ ਹੈਗਾ ਸਮਰ ਕੈਂਪ ਲੱਗਿਆ ਮੈਨੂੰ ਟੀਚਰਸ ਨੇ ਅਤੇ ਮੇਰੇ ਘਰਦਿਆਂ ਨੇ ਮੈਨੂੰ ਕਿਹਾ ਵੀ ਤੈਨੂੰ ਚਿੱਤਰਕਾਰੀ ਦਾ ਸ਼ੌਂਕ ਹੈਗਾ ਤੂੰ ਸਮਰ ਕੈਂਪ ਦੇ ਵਿੱਚ ਟਰਾਈ ਕਰ ਜਾ ਤੈਨੂੰ ਉੱਥੋਂ ਬਹੁਤ ਜ਼ਿਆਦਾ ਕੁਛ ਸਿੱਖਣ ਨੂੰ ਮਿਲੂਗਾ ਤੂੰ ਸਿੱਖ ਉੱਥੋਂ ਮੈਂ ਆਪਣੇ ਘਰਦਿਆਂ ਦੇ ਕਹਿਣ 'ਤੇ ਆਪਣੇ ਟੀਚਰਸ ਦੇ ਕਹਿਣ 'ਤੇ ਜਿਹੜਾ ਹੈਗਾ ਚਿੱਤਰਕਾਰੀ ਦੇ ਵਿੱਚ ਜਿਹੜਾ ਹੈਗਾ ਗਾ ਪਾਰਟੀਸਪੇਟ ਕੀਤਾ ਉੱਥੇ ਮੈਂ ਵਰਕਸ਼ਾਪ ਲਾਈ ਉੱਥੇ ਮੈਂ ਬਹੁਤ ਕੁਛ ਸਿੱਖਿਆ ਬੱਟ ਵੀ ਮੈਨੂੰ ਉੱਥੇ ਸਿੱਖਣ ਦੇ ਵਿੱਚ ਵੀ ਬਹੁਤ ਮਜਾ ਵੀ ਆ ਰਿਹਾ ਸੀ ਉਹ ਮੈਨੂੰ ਨਵੀਆਂ ਨਵੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਿਖਾ ਰਹੇ ਸੀ ਬੱਟ ਜਿਸ ਤਰ੍ਹਾਂ ਜਿਹੜੀ ਮੈਂ ਘਰ ਮੈਂ ਜਿਵੇਂ ਚਿੱਤਰਕਾਰੀ ਕਰ ਰਹਿਨੀ ਰਹਿੰਦੀ ਹੈਗੀ ਹਾਂ ਗੀ ਮੈਨੂੰ ਉਸ ਤਰ੍ਹਾਂ ਜਿਹੜਾ ਹੈਗਾ ਉੱਥੇ ਜਿਹੜਾ ਮਾਹੌਲ ਹੈ ਜਿਹੜਾ ਉਹ ਨਹੀਂ ਮਿਲ ਰਿਹਾ ਸੀ ਬੱਟ ਮੈਂ ਫਿਰ ਵੀ ਉਸ ਚਿੱਤਰਕਾਰੀ ਦੇ ਵਿੱਚ ਬਹੁਤ ਕੁਛ ਸਿੱਖਿਆ ਜਿਵੇਂ ਅਲੱਗ ਅਲੱਗ ਵੀ ਸਪੀਕ ਡਰਾਇੰਗ ਕਰਨੀ ਠੀਕ ਹੈ ਓਨ ਦਾ ਸਪੋਟ ਪੇਂਟਿੰਗ ਕਰਨੀ ਠੀਕ ਹੈ ਇਸ ਤਰ੍ਹਾਂ ਦਾ ਉਸ ਚਿੱਤਰਕਾਰੀ ਦੇ ਵਿੱਚ ਸਿੱਖਿਆ ਉੱਥੋਂ ਜਿਹੜੇ ਟੀਚਰ ਸੀਗੇ ਜਿਹੜੇ ਸਿਖਾ ਰਹੇ ਸੀਗੇ ਮੇਰੇ ਸਪੋਟਰ ਜਿਹੜੇ ਸੀ ਉਹ ਬਹੁਤ ਵਧੀਆ ਸੀ ਉਹਨਾਂ ਨੇ ਬਹੁਤ ਜ਼ਿਆਦਾ ਜਿਹੜੇ ਹੈਗੇ ਹੈਗੇ ਮੈਡਲ ਵਗੈਰਾ ਟ੍ਰੋਫੀ ਵਗੈਰਾ ਜਿੱਤੇ ਹੋਏ ਸੀ ਮੈਨੂੰ ਬਹੁਤ ਖੁਸ਼ੀ ਹੋਈ ਵੀ ਮੈਨੂੰ ਜਿਹੜਾ ਉਹਨਾਂ ਨਾਲ ਕਰਨ ਦਾ ਮੌਕਾ ਮਿਰਿਆ ਮਿਲਿਆ ਅਤੇ ਮੈਂ ਉਹਨਾਂ ਦੇ ਨਾਲ ਜਿਹੜਾ ਹੈਗਾ ਗਾ ਵੀ ਬਹੁਤ ਟਾਇਮ ਜਿਹੜਾ ਹੈਗਾ ਲਾਇਆ ਅਤੇ ਮੈਂ ਬਹੁਤ ਜ਼ਿਆਦਾ ਉੱਥੇ ਜਾ ਕੇ ਖੁਸ਼ ਹੋਈ ਅਤੇ ਮੈਨੂੰ ਉਹ ਵੀ ਮੇਰੇ ਨਾਲ ਕੰਮ ਕਰਕੇ ਜਿਹੜਾ ਹੈਗਾ ਉਹ ਵੀ ਖੁਸ਼ ਹੋਏ ਅਤੇ ਫਿਰ ਉਹਨਾਂ ਨੇ ਮੈਨੂੰ ਇੱਕ ਚਿੱਤਰਕਾਰੀ ਦੇ ਵਿੱਚ ਕੰ ਕੋਪੀਟੀਸ਼ਨ ਦੇ ਵਿੱਚ ਇਹ ਪਾਰਟੀਸਪੇਟ ਲੈਣ ਦੇ ਲਈ ਜਿਹੜਾ ਹੈਗਾ ਇੰਕਰਜ ਕੀਤਾ ਮੈਂ ਉਹਨਾਂ ਦੇ ਕਹਿਣ 'ਤੇ ਪਾਰਟੀਸਪੇਟ ਕੀਤਾ ਵੀ ਬੱਟ ਉੱਥੇ ਮੇਰੀ ਜਿਹੜੀ ਹੈਗੀ ਐਗੀ ਪਜੀਸ਼ਨ ਜਿਹੜੀ ਹੈਗੀ ਐਗੀ ਉਹ ਸੈਕਿੰਡ ਬਣੀ ਬੱਟ ਮੈਂ ਚਾਹੁੰਦੀ ਸੀਗੀ ਵੀ ਜਿਹੜੀ ਮੇਰੀ ਪਜੀਸ਼ਨ ਹੈਗੀ ਆ ਉਹ ਫਸਟ ਬਣੇ ਬੱਟ ਮੈਂ ਬਹੁਤ ਫਿਰ ਵੀ ਖੁਸ਼ ਸੀਗੀ ਕਿਉਂਕਿ ਮੇਰੇ ਜਿਹੜੇ ਟੀਚਰ ਸੀਗੇ ਉਹਨਾਂ ਨੇ ਮੈਨੂੰ ਸਮਝਾਇਆ ਵੀ ਤੂੰ ਆਪਣਾ ਦਿਖਾਇਆ ਜੋ ਚਿੱਤਰਕਾਰੀ ਜਿਹੜੀ ਤੂੰ ਦਿਖਾਈ ਸੋ ਹੋ ਸਕਦਾ ਜਿਹੜੇ ਜੱਜਸ ਹੈਗੇ ਹੈ ਉਹਨਾਂ ਨੂੰ ਉਹਦੇ ਵਿੱਚ ਕੁਛ ਜਿਹੜਾ ਤੂੰ ਕਹਿਣਾ ਚਾਹੁੰਦੀ ਹੈ ਉਹ ਨਾ ਸਮਝ ਲੱਗਾ ਹੋਏ ਸੋ ਮੈਂ ਆਪਣੇ ਆਪ ਨੂੰ ਫਿਰ ਸਮਝਾਇਆ ਵੀ ਸੋ ਵੀ ਚਿੱਤਰਕਾਰੀ ਜਿਹੜੀ ਹੈਗੀ ਹੈਗੀ ਉਹ ਮੈਨੂੰ ਕਦੀ ਛੱਡਣੀ ਨਹੀਂ ਚਾਹੀਦੀ ਕਦੇ ਵੀ ਉਦਾਸ ਨਹੀਂ ਹੋਣਾ ਚਾਹੀਦਾ ਵੀ ਰਿਜਲਟ ਉਹਦਾ ਜੋ ਵੀ ਆਵੇ ਆਪਾਂ ਕੁਛ ਵੀ ਜਿਹੜਾ ਹੈਗਾ ਗਾ ਆਪਾਂ ਨੂੰ ਜ਼ਿੰਦਗੀ ਵਿੱਚ ਸਿੱਖਣਾ ਚਾਹੀਦਾ ਸੋ ਮੇਰਾ ਜਿਹੜਾ ਉਸ ਵਰਕਸ਼ੋਪ ਦਾ ਜਿਹੜਾ ਐਕਸਪੀਰੀਐਂਸ ਸੀਗਾ ਉਹ ਬਹੁਤ ਜ਼ਿਆਦਾ ਵਧੀਆ ਰਿਹਾ ਅਤੇ ਮੈਂ ਉਸ ਤੋਂ ਬਹੁਤ ਜ਼ਿਆਦਾ ਕੁਛ ਸਿੱਖਿਆ